ਸਰਕਾਰੀ ਸਕੂਲਾਂ ਨੂੰ ਕਹਿਣਾ ਚਾਹੀਦਾ ਹੈ ਕਿ ਜਿਹੜੇ ਬੱਚੇ ਖੇਡਾਂ ਦੇ ਵਿੱਚ ਚੰਗੇ ਹਨ ਸ਼ੌਕ ਅਤੇ ਉਹਨਾਂ ਨੂੰ ਪ੍ਰੋਸਾਈਸਤ ਕਰਦਾ ਕਰਨਾ ਚਾਹੀਦਾ ਹੈ ਇਸ ਵਿੱਚ ਸਕੂਲ ਵਾਲੇ ਬੱਚਿਆਂ ਦੇ ਘਰ ਵਾਲਿਆਂ ਨੂੰ ਨਾਲ ਗੱਲਬਾਤ ਕਰਕੇ ਕ ਪਤਾ ਕਰ ਸਕਦੇ ਹਨ ਕਿ ਉਹ ਬੱਚੇ ਵਾਸਤੇ ਕਿਹੜੀ ਚੀਜ਼ ਦੀ ਖੇਡਾਂ ਵਿੱਚ ਜ਼ਰੂਰਤ ਹੈ ਉਸ ਨੂੰ ਲੈ ਕੇ ਦੇ ਸਕਦੇ ਹਨ ਅਤੇ ਜੇ ਨਹੀਂ ਉਹ ਖੁਦ ਬੱਚੇ ਨੂੰ ਆਪਣੀ ਸਰਕਾਰੀ ਖਜ਼ਾਨੇ ਵਿੱਚ ਖਰੀਦ ਕੇ ਬੱਚੇ ਨੂੰ ਦੇਣ ਅਤੇ ਉਸ ਦੀ ਅੱਗੇ ਵਧਣ ਵਿੱਚ ਮਦਦ ਕਰਨਾ ਇਸ ਨਾਲ ਬੱਚੇ ਦਾ ਵੀ ਭਲਾ ਹੁੰਦਾ ਹੈ ਸਰਕਾਰ ਸਰਕਾਰ ਨੂੰ ਇੱਕ ਵਧੀਆ ਅਤੇ ਚੰਗਾ ਖਿਲਾੜੀ ਮਿਲਦਾ ਹੈ ਜੋ ਕਿ ਪੰਜਾਬ ਦਾ ਨਾਮ ਰੌਸ਼ਨ ਕਰਦਾ ਹੈ ਇਸ ਇਸ ਇਸ ਕਰਕੇ ਬੱਚੇ ਦੀ ਮਦਦ ਕਰਨੀ ਚਾਹੀਦੀ ਹੈ ਬੱਚਾ ਕਿਉਂਕਿ ਅੱਗੇ ਵਧੇ ਕੁਛ ਬਣ ਬਣਕ ਬਣ ਸਕੇ